ਸਾਡੇ ਸ਼ਹਿਰ ਵਿੱਚ ਮਛੇਰਿਆਂ ਦੀਆਂ ਜਾਤੀਆਂ ਬਾਰੇ ਤਾਂ ਨਹੀਂ ਪਤਾ ਪ੍ਰੰਤੂ ਕੁਝ ਅਜਿਹੇ ਵਿਅਕਤੀ ਹਨ ਜੋ ਮੱਛੀਆਂ ਫੜਨ ਦਾ ਕੰਮ ਕਰਦੇ ਹਨ ਅਤੇ ਮੱਛੀਆਂ ਵੇਚਦੇ ਹਨ ਅਤੇ ਜੇਕਰ ਉਹਨਾਂ ਦੇ ਤਿਉਹਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੀ ਲਗਭਗ ਮਿਲਦੇ ਜੁਲਦੇ ਤਿਉਹਾਰ ਹੀ ਹਨ ਜੋ ਤਿਉਹਾਰ ਪੰਜਾਬ ਵਿੱਚ ਮਨਾਏ ਜਾਂਦੇ ਹਨ ਉਹ ਵੀ ਸਾਰੇ ਤਿਉਹਾਰਾਂ ਵਿੱਚ ਰਲ ਮਿਲ ਕੇ ਆਪਣੀ ਸ਼ਮੂਲੀਅਤ ਦਿੰਦੇ ਹਨ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਲੋਹੜੀ ਹੋਲੀ ਦੀਵਾਲੀ ਦੁਸ਼ਹਿਰਾ ਅਜਿਹੇ ਤਿਹਾਰਾਂ ਨੂੰ ਓਹ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਅਤੇ ਇੱਕ ਤਿਹਾਰ ਹੈ ਛਠ ਪੂਜਾ ਦਾ ਉਸ ਵਿੱਚ ਵੀ ਉਹਨਾਂ ਦਾ ਕਾਫੀ ਯੋਗਦਾਨ ਰਹਿੰਦਾ ਹੈ ਅਤੇ ਉਸ ਤਿਉਹਾਰ ਨੂੰ ਬੜੀ ਸ਼ਰਧਾ ਦੇ ਨਾਲ ਉਹ ਮਨਾਉਂਦੇ ਹਨ ਅਤੇ ਉਹਨਾਂ ਦੇ ਸਮਾਜ ਵਿੱਚ ਸਾਰੇ ਲੋਕ ਰਲ਼ ਮਿਲ ਕੇ ਰਹਿੰਦੇ ਹਨ ਅਤੇ ਬਾਕੀ ਜਨ ਸਮੂਹ ਵੀ ਉਹਨਾਂ ਨਾਲ਼ ਹਮਦਰਦੀ ਅਤੇ ਪਿਆਰ ਭਾਵਨਾ ਨਾਲ਼ ਰਹਿੰਦੇ ਹਨ